ਮੇਰੇ ਕੋਲ ਇੱਕ ਮਨਪਸੰਦ ਟੀ ਵੀ ਸ਼ੋ ਹੈ ਜਿਹਦਾ ਨਾਮ ਹੈ ਨੇਯਨ ਉਹਦੇ ਵਿੱਚ ਇੱਕ ਲੜਕੀ ਦੀ ਤਾਕਤ ਨੂੰ ਵਿਖਾਇਆ ਗਿਆ ਤਾਕਤ ਕਿਵੇਂ ਕਿ ਉਹ ਪਿਆਰ ਦੇ ਨਾਲ ਜਿਹੜੀ ਹੈ ਉਹ ਵੱਡੀ ਤੋਂ ਵੱਡੀ ਸਿਚੁਏਸ਼ਨ ਨੂੰ ਵੀ ਹੈਂਡਲ ਕਰ ਲੈਂਦੀ ਹੈ ਹਰੇਕ ਦੇ ਨਾਲ ਪਿਆਰ ਨਾਲ ਬੋਲਦੀ ਹੈ ਕਈ ਉਹਦੇ ਨਾਲ ਗੁੱਸੇ ਨਾਲ ਗੱਲ ਕਰਦੇ ਨੇ ਪਰ ਉਹ ਅੱਗੋਂ ਉਹਨਾਂ ਦੇ ਨਾਲ ਪਿਆਰ ਨਾਲ ਬੋਲ ਕੇ ਉਹਨਾਂ ਨੂੰ ਸਹੀ ਰਸਤੇ 'ਤੇ ਲੈ ਆਉਂਦੀ ਹੈ ਹੌਲੀ ਹੌਲੀ ਉਹ ਵੀ ਉਹਦੇ ਨਾਲ ਪਿਆਰ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਨੇ ਇਹ ਵੀ ਨਹੀਂ ਕਰਦੀ ਕਿ ਜਿਹੜਾ ਉਸ 'ਤੇ ਜ਼ੁਲਮ ਕਰਦਾ ਗਾ ਜ਼ੁਲਮ ਸਹਿੰਦੀ ਹੈ ਪਰ ਜ਼ੁਲਮ ਸਹਿੰਦੀ ਨਹੀਂ ਜ਼ੁਲਮ ਦਾ ਮੁਕਾਬਲਾ ਵੀ ਕਰਦੀ ਹੈ ਉਹ ਜ਼ੁਲਮ ਦੇ ਨਾਲ ਲੜਾਈ ਵੀ ਕਰਦੀ ਹੈ ਜਿੱਥੇ ਉਹ ਸਹੀ ਹੈ ਉਹ ਸਹੀ ਹੈ ਆਪਣੇ ਬਾਰੇ ਸਹੀ ਕਹਿੰਦੀ ਹੈ ਅਗਰ ਦੂਸਰਾ ਸਾਹਮਣੇ ਵਾਲਾ ਚਾਹੇ ਉਸਦਾ ਕੋਈ ਸਕਾ ਹੈ ਚਾਹੇ ਨਹੀਂ ਹੈ ਉਹਨੂੰ ਵੀ ਅਗਰ ਉਹ ਸਹੀ ਬੋਲ ਰਿਹਾ ਕੋਈ ਗੱਲ ਤਾਂ ਉਹਨੂੰ ਸਹੀ ਹੀ ਕਹੇਗੀ ਇਹ ਨਹੀਂ ਕਹੇਗੀ ਕਿ ਉਹ ਮੇਰਾ ਦੁਸ਼ਮਣ ਹੈ ਮੇਰੇ ਨਾਲ ਚੰਗਾ ਨਹੀਂ ਬੋਲਦਾ ਅਤੇ ਉਹਨੂੰ ਉਹ ਅਗਰ ਕੋਈ ਗੱਲ ਸਹੀ ਕਰ ਰਿਹਾ ਤਾਂ ਨਹੀਂ ਮੈਂ ਉਹਨੂੰ ਕੈਂਦਾਂ ਕਿ ਉਹ ਗਲਤ ਕਰ ਰਿਹਾ ਨਹੀਂ ਉਹ ਇਸ ਤਰੀਕੇ ਨਾਲ ਨਹੀਂ ਕਹਿੰਦੀ ਉਹ ਇਹ ਕਹਿੰਦੀ ਕਿ ਅਗਰ ਉਹ ਸਹੀ ਹੈ ਤਾਂ ਉਹ ਸਹੀ ਹੈ ਝੂਠ ਨਹੀਂ ਹੈ ਮਤਲਬ ਝੂਠ ਨਹੀਂ ਬੋਲਦੀ ਸਭ ਨੂੰ ਪਿਆਰ ਕਰਦੀ ਹੈ ਸਭ ਦੀ ਇੱਜ਼ਤ ਕਰਦੀ ਹੈ ਇਹ ਚੀਜ਼ਾਂ ਮੈਨੂੰ ਉਹਦੇ ਵਿੱਚ ਵਧੀਆ ਲੱਗੀਆਂ ਇਸ ਕਰਕੇ ਮੈਨੂੰ ਇਹ ਟੀ ਵੀ ਸ਼ੋ ਬਹੁਤ ਪਸੰਦ ਹੈ